ਭੰਗੜਾ ਐਰੋਬਿਕਸ ਵਿਅਕਤੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅਪਣਾਉਣ ਲਈ ਇਕ ਤਰੀਕਿਆਂ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ ਸੱਭਿਆਚਾਰਕ ਸਮਝ ਦਾ ਵਿਕਾਸ ਭੰਗੜਾ ਐਰੋਬਿਕਸ ਮੁਸ਼ਕਿਲ ਅਤੇ ਨੱਚਣ ਦੇ ਤਰੀਕਿਆਂ ਨੂੰ ਸ਼ਾਮਿਲ ਕਰਦਾ ਹੈ ਜੋ ਪੰਜਾਬੀ ਸੱਭਿਆਚਾਰ ਅਤੇ ਇਸ ਦੀ ਮਿਊਜਿਕ ਨਾਲ ਸੰਬੰਧ ਹੁੰਦੇ ਹਨ ਇਸ ਨਾਲ ਵਿਅਕਤੀਆਂ ਨੂੰ ਆਪਣੇ ਸੰਸਾਰ ਅਤੇ ਵਿਰਾਸਤ ਨਾਲ ਜੁੜਨ ਤੋਂ ਮੌਕਾ ਮਿਲਦਾ ਹੈ ਜਿਸਮਾਨੀ ਅਤੇ ਮਨੋਵਿਗਿਆਨਿਕ ਫਾਇਦੇ ਭੰਗੜਾ ਐਰੋਬਿਕਸ ਨਾਲ ਸਿਰਫ ਕਸਰਤ ਹੁੰਦੀ ਹੈ ਬਲਕਿ ਇਹ ਵਿਅਕਤੀ ਨੂੰ ਮਨੋਵਿਗਿਆਨਿਕ ਤੌਰ 'ਤੇ ਵੀ ਸਹਾਇਤਾ ਕਰਦਾ ਹੈ ਕਿਉਂਕਿ ਇਸ ਨਾਲ ਖੁਸ਼ੀ ਅਤੇ ਉਤਸਾਹ ਮਿਲਦਾ ਹੈ ਇਸ ਦੇ ਨਾਲ ਹੀ ਵਿਅਕਤੀਆਂ ਨੂੰ ਸਰਵ ਸਰਮੱਥਾ ਰੱਖਣ ਅਤੇ ਆਪਣੀ ਸਿਹਤ ਨੂੰ ਬਹਾਲ ਕਰਨ ਦਾ ਮੌਕਾ ਮਿਲਦਾ ਸੰਗਠਨ ਅਤੇ ਸਮੂਹਿਕ ਭਾਈਚਾਰੇ ਭੰਗੜਾ ਐਰੋਬਿਕਸ ਦਾ ਅਭਿਆਸ ਜਦੋਂ ਸਮੂਹ ਵਿੱਚ ਹੁੰਦਾ ਹੈ ਤਾਂ ਇਹ ਸਮੂਹ ਭਾਗੇਦਾਰੀ ਅਤੇ ਸਾਂਝੇ ਤਜ਼ਰਬੇ ਨੂੰ ਉਤਸਾਹੀ ਕਰਦਾ ਹੈ ਜਿਸ ਨਾਲ ਲੋਕ ਆਪਣੇ ਸੰਸਾਰ ਸੰਸਾਰਕ ਅਤੇ ਵਿਰਾਸਤ ਦੀ ਮਹੱਤਤਾ ਨੂੰ ਵੱਧ ਲ ਚੰਗੀ ਤਰ੍ਹਾਂ ਸਮਝਦੇ ਹਨ ਭੰਗ ਭੰਗੜਾ ਐਰੋਬਿਕਸ ਦੇ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਲਈ ਸਮੂਹਿਕ ਪ੍ਰੋਗਰਾਮਾਂ ਦੀ ਢਾਂਚੇਬੰਦੀ ਲੋਕਾਂ ਨੂੰ ਸ ਵਧੇਰੇ ਸਥਾਨਾਂ ਅਤੇ ਭੰਗੜਾ ਐਰੋਬਿਕ ਪ੍ਰੋਬਲਮਾਂ ਵਿੱਚ ਸ਼ਾਮਿਲ ਕਰਕੇ ਇਹਨਾਂ ਦੀ ਪ੍ਰਸਿੱਧੀ ਵਧਾਈ ਜਾ ਸਕਦੀ ਹੈ ਇਹ ਸੱਭਿਆ ਸਮਾਜਿਕ ਢੰਗ ਨਾਲ ਵੀ ਲੋਕਾਂ ਨੂੰ ਆਪਣੇ ਸੱਭਿਆਚਾਰ ਜੁੜਨ ਨਾਲ ਜੁੜਨ ਦਾ ਮੌਕਾ ਦੇ ਸਕਦਾ ਹੈ ਨਵੀਂ ਜਵਾਨੀ ਪੀੜ੍ਹੀ ਨਵੀਂ ਜਵਾਨੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਟੈਲੀਵਿਜ਼ਨ ਸੋਸ਼ਲ ਮੀਡੀਆ ਅਤੇ ਇਲੇ ਏ ਇਵੈਂਟਾਂ ਦੇ ਜ਼ਰੀਏ ਭੰਗੜਾ ਐਰੋਬਿਕਸ ਦੀ ਪ੍ਰਸਿੱਧੀ ਨੂੰ ਵਧਾਉਣ ਅਤੇ ਨਵੀਂ ਜਵਾਨੀ ਪੀੜ੍ਹੀ ਨੂੰ ਇਸ ਪ੍ਰਕਾਰ ਦੀ ਕਸਰਤ ਭਾਗੀਦਾਰ ਬਣਾਉਣ ਇੱਕ ਮਹੱਤਮ ਯੋਗਦਾਨ ਹੋ ਸਕਦਾ ਹੈ ਸਿੱਖਿਆ ਦੇ ਮੌਕਿਆਂ ਦੇ ਪ੍ਰਧਾਨਗੀ ਭੰਗੜਾ ਐਰੋਬਿਕਸ ਬਾਰੇ ਸਿੱਖਿਆ ਦਿੱਤੀ ਜਾ ਸਕਦੀ ਹੈ ਅਤੇ ਟ੍ਰੇਨਿੰਗ ਸੈਂਟਰਾਂ ਵਿੱਚ ਇਹ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਜਿਹਨਾਂ ਨਾਲ ਲੋਕਾਂ ਨੂੰ ਸਿੱਖਣ ਅਤੇ ਇਸ ਚੀਜ਼ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ